ਪੰਦਰਾਂ ਇੱਕ ਹਜ਼ਾਰ ਦੋ ਸੌ ਚੌਵੀ ਸੋਲ੍ਹਾਂ ਹਜ਼ਾਰ ਪੰਜ ਸੌ ਤੀਹ ਸੱਤ ਲੱਖ ਤੀਹ ਹਜ਼ਾਰ ਛੇ ਸੌ ਨੌ ਨੌ ਲੱਖ ਦਸ ਹਜ਼ਾਰ ਸੱਤ ਸੌ ਪੰਦਰਾਂ